ਨੌ ਨਵੰਬਰ ਉੱਨੀ ਸੌ ਬਹੱਤਰ ਚੌਵੀ ਨਵੰਬਰ ਦੋ ਹਜ਼ਾਰ ਦੋ ਚੌਵੀ ਨਵੰਬਰ ਦੋ ਹਜ਼ਾਰ ਤਿੰਨ ਨੌ ਅਕਤੂਬਰ ਦੋ ਹਜ਼ਾਰ ਅੱਠ ਉੱਨੀ ਅਗਸਤ ਦੋ ਹਜ਼ਾਰ ਛੇ